ਹੈਲੋ ਹਾਂਜੀ ਮਿਹਰਬਾਨ ਢਾਬੇ ਤੋਂ ਬੋਲ ਰਹੇ ਹੋ ਹਾਂਜੀ ਮੈਂ ਗੁਰਜੀਤ ਕੌਰ ਬੋਲ ਰਹੀ ਹਾਂ ਜੀ ਅਸੀਂ ਕੱਲ੍ਹ ਇੱਕ ਖਾਣੇ ਦਾ ਔਰਡਰ ਦਿੱਤਾ ਸੀ ਜੀ ਤੁਹਾਡੇ ਕੋਲ ਰਿਕਾਰਡ ਹੋਏਗਾ ਜੀ ਉਹ ਖਾਣੇ ਦਾ ਔਰਡਰ ਮੈਂ ਕੈਂਸਲ ਕਰ ਦਿੱਤਾ ਸੀ ਬਾਅਦ ਵਿੱਚੋਂ ਜੀ ਕਿਉਂਕਿ ਸਾਡਾ ਕੁਛ ਮਨ ਬਦਲ ਗਿਆ ਸੀ ਪਰ ਅਸੀਂ ਜਿਹੜੀ ਪੇਮੈਂਟ ਹੈਗੀ ਹੈ ਤੁਹਾਨੂੰ ਉਹ ਔਨਲਾਈਨ ਪਹਿਲਾਂ ਹੀ ਕਰ ਚੁੱਕੇ ਸੀ ਪਰ ਤੁਸੀਂ ਹਜੇ ਸਾਨੂੰ ਉਹ ਪੈਸੇ ਸਾਡੇ ਰਿਫੰਡ ਨਹੀਂ ਕਰੇ ਮਿਹਰਬਾਨੀ ਬਹੁਤ ਬਹੁਤ ਤੁਹਾਡੀ ਹੋਏਗੀ ਅਗਰ ਤੁਸੀਂ ਸਾਡੇ ਉਹ ਪੈਸੇ ਸਾਡੇ ਵਾਪਿਸ ਕਰ ਦਿਉ ਜੀ